ਹੈਲੋ ਨਮਸਕਾਰ ਜੀ ਹਾਂਜੀ ਬੋਲੋ ਜੀ ਹਾਂਜੀ ਹਾਂਜੀ ਇਸ ਲਈ ਫ਼ਸਲ ਤੁਹਾਡੀ ਜੀ ਮੇਨ ਹੈਗਾ ਝੋਨਾ ਝੋਨਾ ਲੱਗ ਸਕਦਾ ਹੈ ਦੂਸਰਾ ਹੈ ਮੂਲੀ ਵਗੈਰਾ ਲਗਾ ਸਕਦੇ ਹੋ ਤੁਸੀਂ ਮੂਲੀ ਵੀ ਜੇ ਤੁਸੀਂ ਲਗਾਉਣੀ ਹੈ ਤਾਂ ਵੱਟਾਂ ਦੇ ਉੱਤੇ ਲਗਾ ਸਕਦੇ ਹੋ ਕਿ ਉਹਨੂੰ ਪਾਣੀ ਨਾ ਲੱਗੇ ਪੂਰੀ ਪਰਾ ਪੂਰੀ ਤਰ੍ਹਾਂ ਹਾਂ ਤਾਂ ਫਿਰ ਇਹ ਹੀ ਹੈ ਮੂਲੀ ਲਗਾ ਸਕਦੇ ਹੋ ਤੁਸੀਂ ਘੀਆ ਲਗਾ ਸਕਦੇ ਹੋ ਹਦੁਆਣਾ ਵਗੈਰਾ ਲਗਾ ਸਕਦੇ ਹੋ ਘੱਟ ਜਗ੍ਹਾ ਦੇ ਵਿੱਚ ਹੀ ਇਹਦੀ ਬੇਲ ਹੋ ਜਾਂਦੀ ਹੈ ਹਾਂਜੀ ਇਹਦੇ 'ਚ ਲਾਗਤ ਇਹਦੇ 'ਚ ਬਾਕੀ ਲਾਗਤ ਕੋਈ ਨਹੀਂ ਪਾਣੀ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਹੈਗੀ ਜ਼ਰੂਰਤ ਨਹੀਂ ਹੈ ਅਤੇ ਖ ਖਰਚਾ ਵੀ ਘੱਟ ਹੈ ਆਮਦਨੀ ਜ਼ਿਆਦਾ ਇਹਦੇ 'ਚ ਗਰਮੀਆਂ 'ਚ ਮੂਲੀ ਵਗੈਰਾ ਦੀ ਇਸ ਲਈ ਆਮਦਨੀ ਜ਼ਿਆਦਾ ਹੈ ਹਾਂਜੀ ਸਰਦੀਆਂ 'ਚ ਮੂਲੀ ਦਾ ਰੇਟ ਕੁਛ ਨਹੀਂ ਹੈ ਇਸ ਲਈ ਮੂਲੀ ਦਾ ਰੇਟ ਜ਼ਿਆਦਾ ਹੁੰਦਾ ਗਰਮੀਆਂ 'ਚ ਉਹ ਲਗਾ ਸਕਦੇ ਹੋ ਹਾਂਜੀ ਹਾਂਜੀ ਹਾਂਜੀ ਅਤੇ ਜੇ ਜਗ੍ਹਾ ਜ਼ਿਆਦਾ ਹੈਗੀ ਆ ਤੁਹਾਡੀ ਫਿਰ ਤਾਂ ਤੁਸੀਂ ਝੋਨਾ ਵਗੈਰਾ ਵੀ ਲਗਾ ਸਕਦੇ ਹੋ

ਹਾਂਜੀ ਠੀਕ ਇਹੀ ਵੈਸੇ ਚੀਜ਼ਾਂ ਹੈਗੀਆਂ ਦੋ ਤਿੰਨ ਇਹ ਲਗਾ ਲਓ ਤੁਸੀਂ ਇਹ 'ਚ ਤੁਹਾਨੂੰ ਮੁਨਾਫ਼ਾ ਹੋਏਗਾ ਹਾਂਜੀ ਠੀਕ ਠੀਕ ਹੈ ਜੀ